ਮੈਂ ਵੀਹ ਦਿਨ ਪਹਿਲਾਂ ਬੈਂਗਲਸ ਔਡਰ ਕੀਤੇ ਸੀ ਅਤੇ ਮੈਨੂੰ ਅੱ ਮੈਨੂੰ ਕੱਲ੍ਹ ਹੀ ਰਿਸੀਵ ਹੋਇਆ ਪਾਰਸਲ ਅਤੇ ਜਦੋਂ ਮੈਂ ਪੈਕਜ਼ਿੰਗ ਖੋਲ੍ਹ ਕੇ ਦੇ ਦੇਖਣ ਲੱਗੀ ਪਹਿਲੇ ਤਾਂ ਉਹਦੀ ਜਿਹੜੀ ਪੈਕਜ਼ਿੰਗ ਸੀ ਉਹ ਬਹੁਤ ਜ਼ਿਆਦਾ ਬੇਕਾਰ ਸੀ ਕੀਤੀ ਹੋਈ ਜਦੋਂ ਮੈਂ ਉਹਦੇ ਵਿੱਚ ਬੈਂਗਲਸ ਦੇਖੀਆਂ ਤਾਂ ਮੈਂ ਮੈਟਲ ਦੀਆਂ ਮੰਗਵਾਈ ਥੀਆਂ ਅਤੇ ਉਹ ਕੱਚ ਦੀਆਂ ਨਿਕਲੀਆਂ ਅਤੇ ਮੈਂ ਮੈਟਲ ਵਿੱਚ ਕਲਰ ਵੀ ਚਲੋ ਜੇ ਮੈਟਲ ਦੇ ਵਿੱਚ ਕਲਰ ਵੀ ਮੈਂ ਰੈ ਰੈੱਡ ਕਲਰ ਮੰਗਵਾਇਆ ਸੀ ਬਟ ਮੈਨੂੰ ਰਿਸੀਵ ਜਿਹੜਾ ਕੱਚ ਦੇ ਵਿੱਚ ਸਿਲਵਰ ਕਲਰ ਹੋਇਆ ਉਹ ਵੀ ਬਹੁਤ ਜ਼ਿਆਦਾ ਮੀਨਿੰਗ ਕਿ ਉਹਦੇ ਵਿੱਚ ਅੱਧੀਆਂ ਚੂੜੀਆਂ 'ਚ ਤਾਂ ਰੈੱਡ ਸੀ ਅਤੇ ਸਿਲਵਰ ਸੀ ਮਿਕਸ ਜਿਹਾ ਕਲਰ ਸੀ ਅਤੇ ਮੈਂ ਆਪਣੀ ਜਦੋਂ ਘਰ ਮੰਮਾ ਨੂੰ ਦੱਸਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਬੋਲਿਆ ਮੈਂ ਔਨਲਾਈਨ ਸ਼ੋਪਿੰਗ ਦੇ ਚਾਅ ਵਿੱਚ ਤਾਂ ਖਰੀਦ ਲਿਆ ਛੇ ਸੌ ਦਾ ਬਟ ਮੈਨੂੰ ਲੱਗਦਾ ਮੈਨੂੰ ਬਾਜ਼ਾਰ ਵਿੱਚੋਂ ਹੀ ਤਿੰਨ ਚਾਰ ਸੌ ਦਾ ਮਿਲ ਜਾਣਾ ਸੀ ਮੈਂ ਕੰਪਨੀ ਨੂੰ ਵੀ ਕੰਪਲੇਨ ਕੀਤੀ ਆ ਬਟ ਮੈਨੂੰ ਨਹੀਂ ਲੱਗਦਾ ਕਿ ਮੇਰੇ ਪੈਸੇ ਉਹ ਰੀਸ ਵਾਪਸ ਕਰਨਗੇ